ਜੇਕਰ ਅਸੀਂ ਪੰਜਾਬ ਮੇਰੇ ਪਿੰਡ ਦੀ ਗੱਲ ਕਰੀਏ ਤਾਂ ਇਸ ਵਿੱਚ ਦੋ ਹੀ ਨਾਚ ਜ਼ਿਆਦਾਤਰ ਪ੍ਰਸਿੱਧ ਹਨ ਪਹਿਲਾਂ ਤਾਂ ਭੰਗੜਾ ਹੈ ਦੂਜਾ ਗਿੱਧਾ ਹੈ ਅਗਰ ਭੰਗੜੇ ਦੀ ਗੱਲ ਕੀਤੇ ਜਾਵੇ ਤਾਂ ਇਹ ਪੰਜਾਬ ਦੇ ਮਰਦਾਂ ਦਾ ਨਾਚ ਹੈ ਭੰਗੜਾ ਪੰਜਾਬ ਦੇ ਮਰਦਾਂ ਦੁਆਰਾ ਹਰ ਖੁਸ਼ੀ ਦੇ ਮੌਕੇ 'ਤੇ ਜਿਵੇਂ ਕਿ ਵਿਆਹ ਦੇ ਮੌਕੇ 'ਤੇ ਪਾਰਟੀ ਦੇ ਮੌਕੇ 'ਤੇ ਜਾਂ ਹਰ ਵੀ ਖੁਸ਼ੀ ਦੇ ਮੌਕੇ 'ਤੇ ਪੰਜਾਬ ਦੇ ਮਰਦਾਂ ਦੁਆਰਾ ਭੰਗੜਾ ਹੀ ਕੀਤਾ ਜਾਂਦਾ ਹੈ ਅਤੇ ਇਸ ਦੇ ਉੱਤੇ ਕਈ ਤਰ੍ਹਾਂ ਦੇ ਕੰਪੀਟੀਸ਼ਨ ਵੀ ਰੱਖੇ ਜਾਂਦੇ ਹਨ ਅਤੇ ਜਿਸ ਵਿੱਚ ਭੰਗੜਾ ਕਰਕੇ ਹਰ ਇੱਕ ਟੀਮ ਆਪਣੀ ਪਰਫੋਰਮੈਸ ਵਗੈਰਾ ਦਿੰਦੀ ਹੈ ਅਤੇ ਇਨਾਮ ਲੈ ਕੇ ਜਾਂਦੀ ਹੈ ਅਗਰ ਗਿੱਧੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਗਿੱਧਾ ਔਰਤਾਂ ਦਾ ਨਾਚ ਹੈ ਇਹ ਨਾਚ ਵੀ ਖੁਸ਼ੀ ਦੇ ਮੌਕੇ 'ਤੇ ਹੀ ਪਾਇਆ ਜਾਂਦਾ ਹੈ ਅਤੇ ਇਸ ਮੌਕੇ ਇਸ ਨੂੰ ਵੀ ਔਰਤਾਂ ਵਿਆਹ ਸ਼ਾਦੀ ਦੇ ਮੌਕੇ 'ਤੇ ਹੀ ਜ਼ਿਆਦਾਤਰ ਪਾਉਂਦੀਆਂ ਹਨ ਜਾਂ ਤਾਂ ਬਰਸਾਤਾਂ ਦੇ ਮੌਸਮ ਵਿੱਚ ਜਦੋਂ ਸਾਉਣ ਦੀ ਪੀਂਘ ਲੱਗਦੀ ਹੈ ਤਾਂ ਉੱਥੇ ਜਾ ਕੇ ਔਰਤਾਂ ਬੋਲੀਆਂ ਪਾਉਂਦੀਆਂ ਹਨ ਅਤੇ ਉਨ੍ਹਾਂ ਬੋਲੀਆਂ ਦੇ ਉੱਤੇ ਗਿੱਧਾ ਪਾ ਕੇ ਨੱਚਦੀਆਂ ਹਨ